ਮੈਂ ਆਪਣੇ ਰਾਜ ਤੋਂ ਬਹੁਤ ਵਾਰ ਬਾਹਰ ਘੁੰਮਣ ਜਾ ਚੁੱਕਿਆ ਹਾਂ ਮੈਨੂੰ ਯਾਦ ਹੈ ਕਿ ਮੈਂ ਇੱਕ ਵਾਰ ਆਪਣੇ ਵੱਡੇ ਵੀਰ ਨੂੰ ਦਿੱਲੀ ਏਅਰਪੋਰਟ 'ਤੇ ਛੱਡਣ ਲਈ ਗਿਆ ਉੱਥੇ ਵੱਖ ਵੱਖ ਪ੍ਰਾਂਤਾਂ ਦੇ ਲੋਕ ਆਏ ਹੋਏ ਸਨ ਕੋਈ ਗੁਜਰਾਤ ਹਰਿਆਣਾ ਹਿਮਾਚਲ ਤੋਂ ਆਇਆ ਹੋਇਆ ਸੀ ਮੈਨੂੰ ਵੱਖ ਵੱਖ ਲੋਕਾਂ ਨਾਲ ਮਿਲਣ ਦੀ ਬਹੁਤ ਦਿਲਚਸਪਸੀ ਸੀ ਤਾਂ ਕਿ ਮੈਂ ਉਹਨਾਂ ਦੇ ਸੱਭਿਆਚਾਰ ਖਾਣ ਪੀਣ ਰੀਤੀ ਰਿਵਾਜ਼ ਪਹਿਰਾਵੇ ਆਦਿ ਬਾਰੇ ਜਾਣ ਸਕਾਂ ਦਿੱਲੀ ਦੀ ਖੂਬਸੂਰਤੀ ਦੇਖ ਕੇ ਮੇਰਾ ਮਨ ਬਹੁਤ ਹੀ ਖੁਸ਼ ਹੋਇਆ ਦਿੱਲੀ ਸਾਡੇ ਭਾਰਤ ਦੇਸ਼ ਦੀ ਰਾਜਧਾਨੀ ਹੈ ਮੈਨੂੰ ਵੱਖ ਵੱਖ ਪ੍ਰਾਂਤਾਂ ਦੇ ਲੋਕਾਂ ਨਾਲ ਮਿਲ ਕੇ ਗੱਲ ਕਰਨ ਅਤੇ ਉਹਨਾਂ ਬਾਰੇ ਜਾਣ ਕੇ ਬਹੁਤ ਖੁਸ਼ੀ ਮਿਲੀ ਦਿੱਲੀ ਦਾ ਅਸੀਂ ਲਾਲ ਕਿਲ੍ਹਾ ਘੁੰਮੇ ਦਿੱਲੀ ਦਾ ਇਹ ਕਿਲ੍ਹਾ ਬਹੁਤ ਵੱਡਾ ਸੀ ਉੱਥੇ ਵੀ ਬਹੁਤ ਸਾਰੇ ਲੋਕ ਘੁੰਮਣ ਆਏ ਹੋਏ ਸਨ ਮੇਰੀ ਯਾਤਰਾ ਦਾ ਮੁੱਖ ਉਦੇਸ਼ ਘੁੰਮਣਾ ਅਤੇ ਵੱਖ ਵੱਖ ਲੋਕਾਂ ਨੂੰ ਮਿਲਣਾ ਅਤੇ ਉਹਨਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸੀ ਦੂਜੇ ਲੋਕ ਵੀ ਸਾਡੇ ਪ੍ਰਾਂਤ ਬਾਰੇ ਜਾਣ ਕੇ ਬਹੁਤ ਖੁਸ਼ ਹੋਏ ਅਸਾਨੂੰ ਇੰਝ ਲੱਗ ਰਿਹਾ ਸੀ ਕਿ ਅਸੀਂ ਪਤਾ ਨਹੀਂ ਕਿਹੜੇ ਦੁਨੀਆਂ ਵਿੱਚ ਅਪੜ ਗਏ ਹੋਈਏ ਦੂਜੇ ਪ੍ਰਾਂਤਾਂ ਦੇ ਸੱਭਿਆਚਾਰ ਸਾਡੇ ਸੱਭਿਆਚਾਰਾਂ ਨਾਲੋਂ ਬਹੁਤ ਹੀ ਵੱਖ ਸਨ ਅਤੇ ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਖਾਣ ਪੀਣ ਦਾ ਤਰੀਕਾ ਵੀ ਸਾਡੇ ਨਾਲੋਂ ਬਹੁਤ ਹੀ ਅਲੱਗ ਸੀ ਮੈਨੂੰ ਇਹ ਸਭ ਕੁਛ ਕਰਨ ਵਿੱਚ ਬਹੁਤ ਮਜ਼ਾ ਆ ਰਿਹਾ ਸੀ ਅਤੇ ਇਹ ਸਭ ਕੁਛ ਕਰਕੇ ਮੇਰੇ ਮਨ ਨੂੰ ਇੱਕ ਪ੍ਰਕਾਰ ਦੀ ਬਹੁਤ ਜ਼ਿਆਦਾ ਖੁਸ਼ੀ ਮਿਲੀ